ਪੰਜਾਬ ਵਿੱਚ ਸੱਭਿਆਚਾਰ ਜਦੋਂ ਵੀ ਕੋਈ ਸੈਲਾਨੀ ਪੰਜਾਬ ਵਿੱਚ ਘੁੰਮਣ ਆਉਂਦਾ ਹੈ ਤਾਂ ਦੇਖਿਆ ਜਾਵੇ ਤਾਂ ਪਹਿਲੀ ਗੱਲ ਪ ਭੋਜਨ ਉਹ ਸਭ ਤੋਂ ਪਹਿਲਾਂ ਇੱਥੇ ਦਾ ਜੋ ਕਿ ਫੇਮਸ ਫੂਡ ਹੈ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਗੁੜ ਦੀ ਚਾਹ ਗੁੜ ਔਰ ਚਾਵਲ ਹੋਰ ਵੀ ਬਹੁਤ ਇੱਥੋਂ ਦੀਆਂ ਫੇਮਸ ਭੋਜਨ ਹੈ ਜੋ ਕਿ ਉੱਥੇ ਦੇ ਉਹ ਬਾਹਰ ਦੇ ਲੋਕ ਇੱਥੇ ਆ ਕੇ ਖਾਂਦੇ ਨੇ ਔਰ ਡਾਂਸ ਦੀ ਗੱਲ ਕਰੀਏ ਤਾਂ ਇੱਥੋਂ ਦਾ ਡਾਂਸ ਸਭ ਤੋਂ ਪ੍ਰਸਿੱਧ ਹੈਗਾ ਭੰਗੜਾ ਔਰ ਗਿੱਧਾ ਜੋ ਕਿ ਅੱਜ ਮੁੰਡੇ ਔਰ ਕੁੜੀਆਂ ਬਹੁਤ ਵਧੀਆ ਕੁੜੀਆਂ ਬਹੁਤ ਵਧੀਆ ਬੋਲੀਆਂ ਪਾਉਂਦੀਆਂ ਹਨ ਮੁੰਡੇ ਵੀ ਬਹੁਤ ਵਧੀਆ ਭੰਗੜਾ ਕਰਦੇ ਹਨ ਕੋਈ ਵੀ ਮੌਕਾ ਹੋਵੇ ਗਿੱਧਾ ਔਰ ਭੰਗੜਾ ਕੋਈ ਨਹੀਂ ਛੱਡਦਾ ਕੋਈ ਵੀ ਭਾਵੇਂ ਖੁਸ਼ੀ ਦਾ ਹੋ ਖੁਸ਼ੀ ਦਾ ਮੌਕਾ ਤਾਂ ਕੋਈ ਛੱਡਦਾ ਹੀ ਨਹੀਂ ਗਿੱਧਾ ਔਰ ਭੰਗੜਾ ਕਰਦੇ ਅਤੇ ਬਾਹਰ ਦੇ ਲੋਕ ਵੀ ਇੱਥੋਂ ਦਾ ਗਿੱਧਾ ਔਰ ਭੰਗੜਾ ਦੇਖਣ ਆਉਂਦੇ ਨੇ ਭੋਜਨ ਖਾਣ ਆਉਂਦੇ ਨੇ ਹੋਰ ਵੀ ਬਹੁਤ ਹੀ ਜ਼ਿਆਦੇ ਸੱਭਿਆਚਾਰ ਪੰਜਾਬ ਦੇ ਹਨ ਜੇਕਰ ਗੱਲ ਕਰੀਏ ਕਿਉਂਕਿ ਪੰਜਾਬ ਭੋਜਨ ਔਰ ਡਾਂਸ ਦਾ ਸਭ ਤੋਂ ਜ਼ਿਆਦੇ ਮੇਨ ਹੈ ਕਿਉਂਕਿ ਲੋਕ ਜਦੋਂ ਵੀ ਬਾਹਰ ਤੋਂ ਆਉਂਦੇ ਉਹ ਇੱਥੇ ਦਾ ਭੋਜਨ ਜ਼ਰੂਰ ਟਰਾਈ ਕਰਦੇ ਹਨ ਕਿੱਥੇ ਦਾ ਕਿਆ ਫੇਮਸ ਹੈ ਉਹ ਡਾਂਸ ਦਾ ਦੇਖਦੇ ਹਨ